ਪੰਜਾਬ ਦੇ ਵਿੱਚ ਦੀ ਸਾਡੇ ਕੋਲ ਜਿਹੜੇ ਮੁੱਖ ਖ਼ਬਰਾਂ ਪ੍ਰਕਾਸ਼ਿਤ ਕਰ ਰਹੇ ਆ ਉਹ ਨਿਊਜ਼ਪੇਪਰ ਆ ਕੁਛ ਉਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜਿਵੇਂ ਕਿ ਅਜੀਤ ਪੇਪਰ ਹੋ ਗਿਆ ਪੰਜਾਬੀ ਟਰਬੂਨ ਦੇਸ਼ ਸੇਵਕ ਅਮਰ ਉਜਾਲਾ ਇਸ ਤਰੀਕੇ ਦੇ ਨਾਲ ਸਾਡੇ ਕੋਲ ਕਈ ਅਖ਼ਬਾਰ ਨੇ ਜਿਨ੍ਹਾਂ ਦੇ ਰਾਹੀਂ ਕੀ ਆ ਲੋਕਾਂ ਨੂੰ ਖ਼ਬਰਾਂ ਦਿੱਤੀਆਂ ਜਾਂਦੀਆਂ ਅਲੱਗ ਅਲੱਗ ਇਹ ਜਿਹੜੇ ਨਿਊਜ਼ ਚੈਨਲ ਨੇ ਇਹਨਾਂ ਦੇ ਪੱਤਰਕਾਰ ਨੇ ਉਹ ਪਿੰਡਾਂ ਦੇ ਵਿੱਚ ਜਾਂਦੇ ਨੇ ਗੱਲਾਂ ਬਾਤਾਂ ਕਰਦੇ ਆ ਜਿਹੜੀ ਵੀ ਖ਼ਬਰ ਲਗਵਾਉਣੀ ਆ ਉਹਦੇ ਬਾਰੇ ਕੀ ਆ ਨੋਟ ਕਰਦੇ ਆ ਲੋਕਾਂ ਨੂੰ ਅਗਿਆਤ ਕਰਦੇ ਆ ਕਿਹਦੇ ਪੈਸੇ ਲੱਗਣਗੇ ਕਿਹਦੇ ਨਹੀਂ ਲੱਗਣਗੇ ਉਸ ਤਰੀਕੇ ਦੇ ਨਾਲ ਇਹ ਇਹਨਾਂ ਦਾ ਇੱਕ ਕਾਫ਼ੀ ਵੱਡਾ ਚੈਨਲ ਆ ਕਿ ਫਰੀ ਖ਼ਬਰਾਂ ਕਿੰਨੇ ਰੁਪਈਆਂ ਦੇ ਵਿੱਚ ਲੱਗਦੀਆਂ ਪੇਮੈਂਟ ਵਾਲੀ ਕਿਹੜੀ ਆ ਹਿਸਾਬ ਕਿਤਾਬ ਦੇ ਨਾਲ ਇਹ ਸਾਰਾ ਕੁਛ ਇਹ ਜਿਹੜੇ ਨਿਊਜ਼ ਚੈਨਲ ਵਾਲੇ ਆ ਜਾਂ ਖ਼ਬਰਾਂ ਵਾਲੇ ਆ ਇਹ ਲੋਕਾਂ ਨੂੰ ਦੱਸਦੇ ਆ ਅਤੇ ਲੋਕ ਇਹਨਾਂ ਕੋਲ ਆਉਂਦੇ ਆ ਦਫ਼ਤਰ ਬਣੇ ਇਹਨਾਂ ਦੇ ਅਲੱਗ ਅਲੱਗ ਉਸ ਹਿਸਾਬ ਦੇ ਨਾਲ ਇਹ ਕੀ ਆ ਲੋਕਾਂ ਨੂੰ ਮੋਟੀਵੇਟ ਕਰਦੇ ਆ ਲੋਕ ਇਹਨਾਂ ਦੇ ਕੋਲ ਆਉਂਦੇ ਆ ਕੋਈ ਗਲਤ ਹੋਇਆ ਚੰਗਾ ਹੋਇਆ ਜੋ ਵੀ ਖ਼ਬਰ ਹੈਗੀ ਇਹਨਾਂ ਨੂੰ ਨੋਟ ਕਰਵਾਉਂਦੇ ਆ ਅਗਰ ਕਿਸੇ ਦਾ ਕੋਈ ਚਾਰਜ ਲੱਗਦਾ ਇਹਦੇ ਬਾਰੇ ਇਹ ਜਾਣਕਾਰੀ ਦਿੰਦੇ ਆ ਤਾਂ ਉਹਦੀ ਇਹ ਪੇਮੈਂਟ ਲੈਂਦੇ ਆ ਜਿਹੜਾ ਫਰੀ ਆ ਇਹ ਉਹ ਫਿਰ ਇਹ ਦੱਸ ਦਿੰਦੇ ਆ ਵੀ ਇਹਦਾ ਕੋਈ ਪੈਸਾ ਨਹੀਂ ਲੱਗਦਾ ਤਾਂ ਲੋਕ ਇਹਨਾਂ ਕੋਲ ਖ਼ਬਰਾਂ ਲਗਵਾਉਂਦੇ ਆ ਜਿਵੇਂ ਕੋਈ ਬੱਚਾ ਵਧੀਆ ਤਰੱਕੀ ਕਰਦਾ ਕੋਈ ਟੈਸਟ ਪਾਸ ਕਰਦਾ ਉਹਦੀ ਖ਼ਬਰ ਹੋ ਗਈ ਕੋਈ ਬੱਚਾ ਫਸਟ ਆਉਂਦਾ ਉਹਦੀ ਖ਼ਬਰ ਹੋ ਗਈ ਜਿਵੇਂ ਆਪਣੇ ਹੁਣ ਟੀਮ ਜਿੱਤ ਕੇ ਆਈ ਆ ਉਹਦੀ ਹੋ ਗਈ ਅਗਰ ਉਹਦੇ ਵਿੱਚ ਕੋਈ ਪੰਜਾਬ ਦਾ ਮੈਂਬਰ ਅਗਰ ਕੋਈ ਮਾੜੀ ਘਟਨਾ ਹੁੰਦੀ ਆ ਉਹਦੇ ਬਾਰੇ ਵੀ ਇਹ ਸਾਰਾ ਕੁਛ ਚਾਨਣਾਂ ਪਾਉਂਦੇ ਆ ਧੰਨਵਾਦ ਜੀ